ਜੀ ਸਤਿ ਸ਼੍ਰੀ ਅਕਾਲ ਮੈਂ ਇੱਕ ਪਰਚੂਨ ਵਿਕਰੇਤਾ ਹਾਂ ਮੈਂ ਆਪਣੇ ਜੀ ਐਸ ਟੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ ਜਿਹੜੀ ਕਿ ਹੁਣ ਮਨਜ਼ੂਰ ਹੋ ਚੁੱਕੀ ਹੈ ਮੈਂ ਹੁਣ ਆਪਣੀ ਦੁਕਾਨ ਵਿੱਚ ਤਰ੍ਹਾਂ ਤਰ੍ਹਾਂ ਦੇ ਸਮਾਨ ਪਾਉਣੇ ਸ਼ੁਰੂ ਕਰ ਰਿਹਾ ਹਾਂ ਮੈਂ ਆਪਣੇ ਵਪਾਰ ਨੂੰ ਆਨਲਾਈਨ ਕਾਰੋਬਾਰ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਹਾਂ ਅਤੇ ਅੱਜ ਕੱਲ੍ਹ ਆਨਲਾਈਨ ਪੇਮੈਂਟ ਦੇ ਜਮਾਨੇ ਵਿੱਚ ਅੱਗੇ ਵਧਾਉਣਾ ਚਾਹੁੰਦਾ ਹਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੇਰੀ ਅਰਜ਼ੀ ਦਾ ਪੁਸ਼ਟੀਕਰਨ ਹੋ ਚੁੱਕਿਆ ਹੈ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਨ ਵਿੱਚ ਹੁਣ ਜ਼ਿਆਦਾ ਦੇਰ ਨਹੀਂ ਕਰ ਸਕਦਾ ਕਿਉਂ ਕਿ ਮੈਂ ਬੈਂਕ ਲੋਨ ਦੀਆਂ ਕਿਸ਼ਤਾਂ ਵੀ ਜਮ੍ਹਾਂ ਕਰਵਾਉਣੀਆਂ ਹਨ ਧੰਨਵਾਦ